ਸਮੇਂ ਦੇ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਘੱਟ ਰਹੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਇਸ ਲਈ ਘੱਟ ਰਹੀ ਹੈ ਕਿ ਬੱਚੇ ਆਈਲੈਟਸ ਕਰਕੇ ਬਾਹਰ ਜਾਣ ਦਾ ਦੇਖ ਰਹੇ ਹਨ ਇਸ ਲਈ ਪੰਜਾਬੀ ਭਾਸ਼ਾ ਵਿੱਚ ਕਾਫੀ ਫਰਕ ਆ ਰਿਹਾ ਹੈ ਉਹ ਵੀ ਸਕ ਸਕੂਲਾਂ ਕਾਲਜਾਂ ਵਿੱਚ ਵੀ ਦਸਵੀਂ ਤੋਂ ਬਾਅਦ ਪੰਜਾਬੀ ਬਹੁਤ ਘਾ ਪੰਜਾਬੀ ਮੀਡੀਅਮ ਖਤਮ ਕਰ ਦਿੱਤਾ ਗਿਆ ਹੈ ਤੇ ਇੰਗਲਿਸ਼ ਨੂੰ ਇੰਗਲਿਸ਼ ਹਿੰਦੀ ਨੂੰ ਅਹੁਦਾ ਦਿੱਤਾ ਗਿਆ ਹੈ ਇਸ ਲਈ ਪੰਜਾਬੀ ਭਾਸ਼ਾ ਬਹੁਤ ਘੱਟ ਗਈ ਹੈ ਸੱਭਿਆਚਾਰਕ ਸੱਭਿਆਚਾਰਕ ਦੇ ਪ੍ਰਭਾਵ ਨਾਲ ਐਹ ਫਰਕ ਪਿਆ ਕਿ ਆਪਣਾ ਕਲਚਰ ਛੱਡ ਕੇ ਪੰਜਾਬੀ ਅਤੇ ਬਾਹਰ ਦੇ ਕਲਚਰ ਨੂੰ ਅਪਣਾ ਰਹੇ ਹਨ ਇ ਇਸ ਲਈ ਪੰਜਾਬੀ ਭਾਸ਼ਾ ਵਿੱਚ ਕਾਫੀ ਫਰਕ ਪਿਆ ਹੈ ਇਸ ਨਾਲ ਸ ਇਹ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪੰਜਾਬੀ ਲਾਜ਼ਮੀ ਕਰ ਦਿੱਤੀ ਜਾਵੇ ਪੰਜਾਬ ਬੱਚੇ ਬਾਹਰ ਵੱਲ ਨਾ ਭੱਜਣਗੇ ਅਤੇ ਆਪਾਂ ਉਹਨਾਂ ਦਾ ਕਲਚਰ ਨਾ ਅਪਣਾਣਗੇ ਦੇ ਇਸ ਲਈ ਫਿਰ ਪੰਜਾਬੀ ਭਾਸ਼ਾ ਦੀ ਵਰਤੋਂ ਹੋਏਗੀ ਨਹੀਂ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਘੱਟ ਗਈ ਹੈ ਸਮੇਂ ਦੇ ਨਾਲ ਕਾਫੀ ਬਦਲਾਵ ਆ ਗਿਆ ਹੈ ਪਹਿਲਾ ਤਾਂ ਹੁੰਦਾ ਸੀ ਕਿ ਜੀ ਕਰਕੇ ਬੋਲਦੇ ਸੀ ਅਤੇ ਬਹੁਤ ਓਹ ਹੁੰਦਾ ਸੀ ਪੰਜਾਬੀ ਦਾ ਮਹੱਤਵ ਹੁਣ ਤਾਂ ਪੰਜਾਬੀ ਦਾ ਮਹੱਤਵ ਬਹੁਤ ਘੱਟ ਗਿਆ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਆਪਣਾ ਪੰਜਾਬ ਦਾ ਨਾਮ ਆਪਣੀ ਮਾਂ ਤਾਂ ਮਾਂ ਬੋਲੀ ਪੰਜਾਬੀ ਨੂੰ ਅੱਗੇ ਰੱਖਣਾ ਚਾਹੀਦਾ ਹੈ ਆਪਣੇ ਕਲਚਰ ਨੂੰ ਨਹੀਂ ਭੁੱਲਣਾ ਚਾਹੀਦਾ ਬਾਹਰ ਜਾ ਕੇ ਵੀ ਇਸ ਲਈ ਪੰਜਾਬੀ ਸਭ ਤੋਂ ਜ਼ਰੂਰੀ ਏ ਸੱਭਿਆਚਾਰਕ ਦੇ ਨਾਲ ਪ੍ਰਭਾਵ ਦੇ ਅੰਗਰੇਜ਼ਾਂ ਫਰਕ ਪਿਆ ਹੈ ਪਰ ਆਪਣਾ ਵੀ ਮਾਂ ਬੋਲੀ ਪੰਜਾਬੀ ਨਹੀਂ ਭੁੱਲਣੀ ਚਾਹੀਦੀ ਸਾਨੂੰ